ਸਤਿ ਸ਼੍ਰੀ ਅਕਾਲ ਜੀ ਮੈਂ ਰੇਲ ਗੱਡੀ ਦਾ ਵਰਨਣ ਕਰਨ ਜਾ ਰਿਹਾ ਜਿੱਦਾਂ ਰੇਲ ਗੱਡੀ ਦੀ ਸੀਟਾਂ ਵਿੱਚ ਇੰਜਣ ਸ਼ੋਰ ਪਹੀਏ ਟਰੈਕ ਆਦਿ ਹੁੰਦੇ ਆ ਜੀ ਮੈਂ ਰੇਲ ਗੱਡੀ 'ਚ ਯਾਤਰਾ ਕੀਤੀ ਸੀ ਕਿ ਮੇਰੀ ਸਭ ਤੋਂ ਪਹਿਲੀ ਰੇਲ ਗੱਡੀ ਦੀ ਯਾਤਰਾ ਹਜ਼ੂਰ ਸਾਹਿਬ ਯਾਤ ਦੀ ਸੀ ਅਤੇ ਮੈਂ ਸੱਚਖੰਡ ਸ਼੍ਰੀ ਗੱਡੀ ਸੱਚਖੰਡ ਗੱਡੀ ਬੁੱਕ ਕੀ ਕਰਵਾਈ ਸੀ ਮੈਂ ਉਸ ਸਮੇਂ ਆਪਣੇ ਪਰਿਵਾਰ ਦੇ ਨਾਲ਼ ਗਿਆ ਸੀ ਮੇਰੀ ਘਰਵਾਲੀ ਅਤੇ ਮੇਰੇ ਬੱਚੇ ਮੇਰੇ ਨਾਲ਼ ਸੀ ਉਸ ਵੇਲੇ ਮੈਂ ਚਾਰ ਸੀਟਾਂ ਬੁੱਕ ਕੀਤੀਆਂ ਸੀ ਉੱਦਾਂ ਤਾਂ ਉਹ ਥ ਜਬੇ ਜੱਥੇਦਾਰ ਵੱਲੋਂ ਗੱਡੀ ਗਈ ਸੀ ਜੱਥੇ ਵੱਲੋਂ ਸਾਰੀ ਸੰਗਤ ਗਈ ਸੀ ਅਤੇ ਅਸੀਂ ਗੱਡੀ ਵਿੱਚ ਸਾਰੇ ਰਸਤੇ ਵਿੱਚ ਕੀਰਤਨ ਕਰਦੇ ਗਏ ਸੀ ਪਰ ਗੱਡੀ ਦਾ ਸਫ਼ਰ ਬੜਾ ਹੀ ਵਧੀਆ ਸੀ ਗੱਡੀ ਨੇ ਸਾਨੂੰ ਸਾਡੇ ਸਮੇਂ ਤੋਂ ਪਹਿਲੇ ਪਹੁੰਚਾ ਦਿੱਤਾ ਸੀ ਹਜ਼ੂਰ ਸਾਹਿਬ ਦਾ ਜਾਣ ਦਾ ਸਮਾਂ ਅਠਤਾਲੀ ਘੰਟੇ ਦਾ ਹੁੰਦਾ ਸੀ ਪਰ ਉਸ ਨੇ ਸਾਨੂੰ ਸੰਤਾਲੀ ਘੰਟਿਆਂ ਵਿੱਚ ਉੱਥੇ ਪਹੁੰਚਾ ਦਿੱਤਾ ਸੀ ਅਸੀਂ ਇੱਕ ਰਾਤ ਵਿੱਚ ਗੱਡੀ ਦੇ ਰਹੇ ਸੀ ਰਹੇ ਸੀ ਗੱਡੀ ਇੰਨੇ ਸਟੇਸ਼ਨਾਂ 'ਤੇ ਵੀ ਨਹੀਂ ਰੁਕੀ ਸੀ ਕਿ ਕੁਝ ਹੀ ਮੇਨ ਸਟੇਸ਼ਨਾਂ 'ਤੇ ਰੁਕੀ ਰਹੀ ਸੀ ਅਤੇ ਗੱਡੀ ਵਿੱਚ ਅਸੀਂ ਖਾਣ ਪੀਣ ਦਾ ਸਮਾਨ ਆਪਣਾ ਲੈ ਕੇ ਗਏ ਸੀ ਸਾਨੂੰ ਇੰਨੀ ਪਰੇਸ਼ਾਨੀ ਨਹੀਂ ਆਈ ਕਿ ਕੁਝ ਮੇਨ ਸਟੇਸ਼ਨਾਂ 'ਤੇ ਜਦੋਂ ਗੱਡੀ ਰੁਕੀ ਸੀ ਤਾਂ ਜਦੋਂ ਸਾਡਾ ਸਾਰਾ ਸਮਾਨ ਮੁੱਕਿਆ ਤਾਂ ਅਸੀਂ ਲੈ ਲਿਆ ਸੀ ਗੱਡੀ ਦੇ ਵਿੱਚ ਅਸੀਂ ਇੱਕ ਰਾਤ ਬੜੇ ਹੀ ਆਰਾਮਦਾਇਕ ਤਰੀਕੇ ਨਾਲ਼ ਕੱਢੀ ਸੀ ਅਸੀਂ ਸਾਰੇ ਰਸਤੇ ਪਾਠ ਨੂੰ ਜਪਦੇ ਗਏ ਅਤੇ ਸਾਨੂੰ ਰਸਤੇ ਵਿੱਚ ਨ ਦਾ ਵੀ ਇਹਨਾਂ ਵੀ ਪਤਾ ਨਹੀਂ ਲੱਗਿਆ ਅਤੇ ਗੱਡੀ ਵਿੱਚ ਸੌਣ ਵਾਸਤੇ ਗਰਮੀਆਂ ਵਿੱਚ ਪੱਖੇ ਪੱਖੇ ਵੀ ਲੱਗੇ ਹੋਏ ਸਨ ਟਿਊਬਾਂ ਵੀ ਲੱਗੀਆਂ ਹੋਈਆਂ ਜਦੋਂ ਸ਼ਾਮ ਦੇ ਵੇਲ਼ੇ ਹਨੇਰਾ ਹੋ ਜਾਵੇ ਤਾਂ ਅਸੀਂ ਟਿਊਬਾਂ ਜਗਾ ਸਕਦੇ ਸੀ ਤਾਂ ਉਹ ਗੱਡੀ ਗੱਡੀ ਵਧੀਆ ਸੀ ਇਸ ਦੀ ਟਿਕਟ ਵੀ ਇੰਨੀ ਜ਼ਿਆਦਾ ਨਹੀਂ ਸੀ ਮੇਰੀ ਉਹ ਯਾਤਰਾ ਸਭ ਤੋਂ ਵਧੀਆ ਗਈ ਸੀ ਕਿਉਂਕਿ ਅਸੀਂ ਸਾਰੇ ਰਸਤੇ ਵਿੱਚ ਰਲ਼ ਮਿਲ ਕੇ ਸੰਗਤ ਦੇ ਨਾਲ਼ ਗਏ ਸੀ ਧੰਨਵਾਦ ਜੀ